ਪੰਜਾਬੀ ਭਾਸ਼ਾ ਨੂੰ ਸੁਰੱਖਿਅਤ ਕਰਨ ਲਈ ਜੋ ਮੁੱਖ ਤੌਰ 'ਤੇ ਸਰਕਾਰਾਂ ਵੱਲੋਂ ਕਾਫ਼ੀ ਵੱਡੇ ਪੱਧਰ 'ਤੇ ਯਤਨ ਕੀਤੇ ਜਾਂਦੇ ਹਨ ਅਤੇ ਕਰ ਵੀ ਰਹੇ ਹਨ ਪੰਜਾਬੀ ਭਾਸ਼ਾ ਦੇ ਮੇਲੇ ਸਾਹਿਤਕ ਮੇਲੇ ਕਵਿਤਾਵਾਂ ਕਵਿਸ਼ਰੀਆਂ ਜੋ ਮੇਲਿਆਂ ਦੇ ਵਿੱਚ ਪੰਜਾਬੀ ਭਾਸ਼ਾ ਵਿੱਚ ਗਾਈਆਂ ਜਾਂਦੀਆਂ ਹਨ ਅਤੇ ਸਰਕਾਰ ਵੱਲੋਂ ਪਿਛਲੇ ਦਿਨੀਂ ਇੱਕ ਬਹੁਤ ਵਧੀਆ ਫੈਸਲਾ ਜੋ ਲਿਆ ਗਿਆ ਹੈ ਕਿ ਜਿਹੜਾ ਵੀ ਵਿਦਿਆਰਥੀ ਸਰਕਾਰੀ ਪੇਪਰ ਦਿੰਦਾ ਹੈ ਉਹਨੂੰ ਸਭ ਤੋਂ ਪਹਿਲਾਂ ਪੰਜਾਬੀ ਭਾਸ਼ਾ ਦਾ ਪੰਜਾਬੀ ਵਿਆਕਰਨ ਦਾ ਜੋ ਪੰਜਾਹ ਨੰਬਰ ਦਾ ਪੇਪਰ ਦੇਣਾ ਪੈਣਾ ਲਾਜ਼ਮੀ ਕੀਤਾ ਗਿਆ ਹੈ ਜਿਹਦੇ ਵਿੱਚ ਹਰ ਇੱਕ ਵਿਦਿਆਰਥੀ ਨੂੰ ਆਪਣੇ ਸੱਭਿਆਚਾਰਕ ਆਪਣੇ ਪੇਂਡੂ ਜੋ ਮੇਲੇ ਹੈ ਉਹਨਾਂ ਦੇ ਪ੍ਰਤੀ ਜਾਣਕਾਰੀ ਗੁਰਬਾਣੀ ਪ੍ਰਤੀ ਜਾਣਕਾਰੀ ਅਤੇ ਭਾਸ਼ਾ ਦਾ ਗਿਆਨ ਵਿਆਕਰਨ ਦਾ ਗਿਆਨ ਹੋਣਾ ਲਾਜ਼ਮੀ ਜੋ ਸਰਕਾਰ ਵੱਲੋਂ ਕੀਤਾ ਹੈ ਜੋ ਕਿ ਲੱਗਦਾ ਹੈ ਕਿ ਇੱਕ ਬਹੁਤ ਵਧੀਆ ਉਪਰਾਲਾ ਹੈ ਜਿਹਦੇ ਕਰਕੇ ਸਾਡੇ ਨੌਜਵਾਨ ਬੱਚੇ ਜੋ ਭਾਸ਼ਾ ਨੂੰ ਪੰਜਾਬੀ ਨੂੰ ਪੜ੍ਹਦੇ ਹਨ